ਟੈਕਨੋਲੋਜੀ ਦੀ ਵਰਤੋਂ ਨੇ ਸੰਸਾਰ ਵਿੱਚ ਸਾਡੇ ਆਲੇ ਦੁਆਲੇ ਗੱਲ ਕਰਨ ਦੇ ਤਰੀਕੇ ਨੂੰ ਕਾਫੀ ਬਦਲ ਦਿੱਤਾ ਕਿ ਜਿੱਦਾਂ ਪਹਿਲਾਂ ਲੋਕ ਸੀ ਉਹ ਆਪਣੇ ਕੋਈ ਵੀ ਗੱਲ ਲਿਖਣ ਲਈ ਮਤਲਬ ਦੱਸਣ ਲਈ ਚਿੱਠੀਆਂ ਲਿਖਦੇ ਸੀ ਪਰ ਅੱਜ ਦੇ ਅੱਜ ਅੱਜ ਦੇ ਸੰਸਾਰ ਵਿੱਚ ਲੋਕ ਜਿਹੜੇ ਆ ਉਹ ਵਟਸਐਪ ਇੰਸਟਾਗ੍ਰਾਮ ਫੇਸਬੁੱਕ ਵਗੈਰਾ ਦਾ ਯੂਜ ਕਰਕੇ ਆਪਣੇ ਜਿਹੜੇ ਆ ਗੱਲਬਾਤ ਨੂੰ ਸਿੱਧਾ ਮੈਸਜ ਨਾਲ ਸ਼ੇਅਰ ਕਰ ਦਿੰਦੇ ਆ ਕੋਲ ਕਰ ਕੇ ਆਪਣੀ ਗੱਲਬਾਤ ਜਿਹੜੀ ਆ ਉਹ ਕਰ ਲੈਂਦੇ ਉਹ ਸ਼ੋਸ਼ਲ ਮੀਡੀਆ ਨੇ ਲੋਕਾਂ ਨੂੰ ਨੇੜੇ ਆਉਣ ਵਿੱਚ ਬਹੁਤ ਮਦਦ ਕੀਤੀ ਹੈ ਕਿ ਆਪਾਂ ਜਿਹੜੇ ਮੈਸੇਜ ਆ ਉਹ ਭੇਜ ਸਕਦੇ ਹਾਂ ਸ਼ੋਸ਼ਲ ਮੀਡੀਆ ਦੇ ਕੁਝ ਸਕਾਰਾਤਮਕ ਵੀ ਨਤੀਜੇ ਹਨ ਅਤੇ ਕੁਝ ਨਕਾਰਾਤਮਕ ਵੀ ਹਨ ਜਿੱਦਾਂ ਕਿ ਯੂਟੀਊਬ 'ਤੇ ਆਪਾਂ ਪੜ੍ਹ ਕੇ ਬਹੁਤ ਸਾਰੀਆਂ ਜੋਬਸ ਹਾਸਿਲ ਕਰ ਸਕਦੇ ਐ ਜਿੱਦਾਂ ਇੰਸਟਾ ਫੇਸਬੁੱਕ 'ਤੇ ਵੀ ਕਾਫੀ ਸਾਰੇ ਫਾਇਦੇ ਹਨ ਪਰ ਫਾਇਦੇ ਦੇ ਨਾਲ ਨਾਲ ਉਹਨਾਂ ਦੇ ਬਹੁਤ ਸਾਰੇ ਨੁਕਸਾਨ ਵੀ ਹਨ ਜਿੱਦਾਂ ਕਿ ਇੰਸਟਾ ਦੇ ਕਈ ਸਾਰੇ ਲੋਕ ਆ ਜਿਹੜੇ ਉਹਨੂੰ ਯੂਜ ਕਰ ਕੇ ਪੈਸੇ ਕਮਾ ਰਹੇ ਹੈ ਆ ਪਰ ਕਈ ਸਾਰੇ ਬੱਚੇ ਉੱਥੇ ਆਪਣਾ ਜ਼ਿਆਦਾ ਟਾਈਮ ਵੇਸਟ ਕਰੇ ਕਰਦੇ ਆ ਆਪਣੇ ਲਕਸ਼ ਤੋਂ ਭਟਕੇ ਕਰਦੇ ਆ ਅਤੇ ਆਪਣੀਆਂ ਜਿਹੜੀਆਂ ਮਤਲਬ ਗਲਤ ਮੈਸੇਜਿਸ ਵਗੈਰਾ ਕਰਦੇ ਹੈ ਆਪਣਾ ਟਾਈਮ ਜਿਹੜਾ ਉਹ ਵੇਸਟ ਕਰ ਕੇ ਆ ਪੜ੍ਹਾਈ ਤੋਂ ਜਿਹੜਾ ਉਹ ਮਨ ਹਟਾਉਂਦੇ ਆ ਧੰਨਵਾਦ